ਆਉਣ ਵਾਲੇ ਸਮੇਂ ਦੇ ਵਿੱਚ ਬਿਹਤਰ ਇਲਾਜ ਲਈ ਅਸੀਂ ਹਸਪਤਾਲ ਜਾਣਾ ਪਸੰਦ ਕਰਦੇ ਹਾਂ ਕਿਉਂਕਿ ਹਸਪਤਾਲਾਂ ਦੇ ਵਿੱਚ ਟੈਕਨੋਲੋਜੀ ਬਹੁਤ ਅਡਵਾਂਸ ਹੈ ਹਰ ਤਰ੍ਹਾਂ ਦਾ ਡਾਕਟਰ ਮਿਲ ਜਾਂਦਾ ਜਿਵੇਂ ਕਿ ਦਿਮਾਗ ਦਾ ਸਪੈਸ਼ਲਿਸਟ ਮਿਲ ਜਾਂਦਾ ਵਾ ਅੱਖਾਂ ਦਾ ਕੰਨਾਂ ਦਾ ਜਾਂ ਦੰਦਾਂ ਦੇ ਡਾਕਟਰ ਵੱਖਰੇ ਨੀ ਕਿ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਮਿਲ ਜਾਂਦਾ ਵਾ ਆਪਾਂ ਨੂੰ ਸਾਰੀ ਇਨਵੈਸਟੀਗੇਸ਼ਨ ਹੋ ਜਾਂਦੀ ਹੈ ਟੈਸਟ ਹੋ ਜਾਂਦੇ ਆ ਇਸੇ ਤਰੀਕੇ ਦੇ ਨਾਲ ਇਲਾਜ ਬਿਹਤਰ ਵਧੀਆ ਹੁੰਦਾ ਵਾ ਜਿਹਦੇ ਨਾਲ ਸਾਡਾ ਜਿਹੜਾ ਵਾ ਭਵਿੱਖ ਉਜਵੱਲ ਹੈ ਜੇ ਅਸੀਂ ਘਰੇਲੂ ਉਪਚਾਰਾਂ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ ਅਤੇ ਫਿਰ ਬਿਮਾਰੀ ਨੂੰ ਹੋਰ ਜ਼ਿਆਦਾ ਬੜਾਵਾ ਦਿੰਦੇ ਹਾਂ ਉਹਦੇ ਨਾਲ ਬਿਮਾਰੀਆਂ ਵੱਧਦੀਆਂ ਵਾ ਘੱਟਦੀਆਂ ਨਹੀਂ ਆ ਮਾੜਾ ਮੋਟਾ ਜੇ ਕੋਈ ਜਿਵੇਂ ਜ਼ੁਕਾਮ ਹੋ ਗਿਆ ਭਾਫ ਲੈ ਲਈ ਜਾਂ ਕੋਈ ਦਰਦ ਦੁਰਦ ਹੋ ਗਈ ਤੇਲ ਮਾਲਿਸ਼ ਕਰ ਲਈ ਇਹੋ ਜਿਹਾ ਉਪਚਾਰ ਜਿਹੜਾ ਉਹ ਘਰ ਦੇ ਵਿੱਚ ਕਰ ਲੈਣਾ ਚਾਹੀਦਾ ਵਾ ਬਾਕੀ ਜ਼ਿਆਦਾਤਰ ਹਸਪਤਾਲ 'ਚ ਜਾਣਾ ਹੀ ਲੋਕ ਪਸੰਦ ਕਰਦੇ ਆ